ਪਾਣੀ ਨੂੰ ਸਾਫ ਕਰਨ ਦੇ ਲਈ ਕਈ ਤਰੀਕੇ ਵਰਤੇ ਜਾਂਦੇ ਆ ਪਰ ਜੋ ਅਸੀਂ ਘਰਾਂ ਦੇ ਵਿੱਚ ਵਰਤਦੇ ਹਾਂ ਉਹ ਹੈ ਇੱਕ ਮਿੱਟੀ ਦਾ ਘੜਾ ਅਤੇ ਇੱਕ ਅਸੀਂ ਪਾਣੀ ਨੂੰ ਉਬਾਲਣਾ ਪਹਿਲਾਂ ਮਿੱਟੀ ਦੇ ਘੜੇ ਵਿੱਚ ਪਹਿਲਾਂ ਸਮੇਂ ਤੋਂ ਹੀ ਮਿੱਟੀ ਦਾ ਘੜਾ ਆ ਜੋ ਅਸੀਂ ਜ਼ਿਆਦਾ ਵਰਤਦੇ ਸੀ ਘਰਾਂ ਦੇ ਵਿੱਚ ਜਦੋਂ ਅਸੀਂ ਮਿੱਟੀ ਦੇ ਘੜੇ ਵਿੱਚ ਪਾਣੀ ਨੂੰ ਪਾਉਂਦੇ ਹਾਂ ਅਤੇ ਉਹਦੇ ਦੇ ਜਿਹੜੇ ਸਾਰੇ ਕੀਟਾਣੂ ਆ ਉਹ ਖਤਮ ਹੋ ਜਾਂਦੇ ਆ ਅਤੇ ਪਾਣੀ ਆਂ ਜੋ ਬਿਲਕੁਲ ਸਾਫ ਹੋ ਜਾਂਦਾ ਜਿਹਨੂੰ ਅਸੀਂ ਪੀ ਸਕਦੇ ਹਾਂ ਅਤੇ ਮਿੱਟੀ ਦੇ ਘੜੇ ਵਿੱਚ ਜੋ ਪਾਣੀ ਹੈ ਉਹ ਠੰਡਾ ਵੀ ਰਹਿੰਦਾ ਆ ਅਤੇ ਲੋਕਾਂ ਨੂੰ ਉਹ ਚੰਗਾ ਲੱਗਦਾ ਪੀਣ ਦੇ ਵਿੱਚ ਅਤੇ ਦੂਸਰਾ ਹੈ ਪਾਣੀ ਨੂੰ ਉਬਾਲਣਾ ਪਾਣੀ ਨੂੰ ਜਦੋਂ ਅਸੀਂ ਉਬਾਲਦੇ ਹਾਂ ਤਾਂ ਪਾਣੀ ਦੇ ਜਿਹੜੇ ਕੀਟਾਣੂ ਆ ਉਹ ਸਾਰੇ ਖਤਮ ਹੋ ਜਾਂਦੇ ਆ ਅਤੇ ਉਸ ਅਸੀਂ ਪਾਣੀ ਨੂੰ ਉਬਾਲ ਕੇ ਗਰਮ ਪਾਣੀ ਨੂੰ ਅਸੀਂ ਠੰਡਾ ਕਰਕੇ ਫਿਰ ਉਸਨੂੰ ਪੀ ਸਕਦੇ ਹੈ ਅਤੇ ਤੀਸਰਾ ਹੈ ਪਾਣੀ ਦੇ ਵਿੱਚ ਲਾਲ ਦਵਾਈ ਪਾਉਣਾ ਕਈ ਵਾਰ ਪਾਣੀ ਆ ਜਾਂ ਉਹ ਮਿੱਟੀ ਦੇ ਨਾਲ਼ ਮਿਲ ਕੇ ਸਾਡੇ ਘਰਾਂ ਦੇ ਵਿੱਚ ਆਉਂਦਾ ਆ ਅਤੇ ਉਹ ਪਾਣੀ ਗੰਦਾ ਹੁੰਦਾ ਅਤੇ ਅਸੀਂ ਉਸ ਪਾਣੀ ਨੂੰ ਲਾਲ ਦਵਾਈ ਪਾ ਕੇ ਅਸੀਂ ਉਸ ਪਾਣੀ ਨੂੰ ਸਾਫ ਕਰ ਸਕਦੇ ਹਾਂ ਅਤੇ ਉਸ ਪਾਣੀ ਨੂੰ ਪੀਣ ਯੋਗ ਜਾਂ ਵਰਤਣ ਯੋਗ ਬਣਾ ਸਕਦੇ ਹਾਂ